ਹਾਂਜੀ ਮੈਮ ਮੈਂ ਸਪੋਰਟਸ ਰਿਲੇਟਡ ਕੁਛ ਕੋਸ਼ਨ ਪੁੱਛਣੇ ਸੀ ਪੰਜਾਬ ਵਿੱਚ ਕਿਹੜੀਆਂ ਖੇਡਾਂ ਨੇ ਜੋ ਜ਼ਿਆਦਾ ਪ੍ਰਸਿੱਧ ਨੇ ਹਾਂਜੀ ਅਤੇ ਸਾਡੇ ਸਕੂਲ ਵਿੱਚ ਕਾਹਦੀ ਕਾਹਦੀ ਕੋਚਿੰਗ ਦਿੱਤੀ ਜਾਂਦੀ ਹੈ ਕਿਹੜੀ ਖੇਡਾਂ ਦੀ ਅਤੇ ਜੇ ਮੈਂ ਹੋਕੀ ਦੀ ਕੋਚਿੰਗ ਵਗੈਰਾ ਜੁਆਇਨ ਕਰਨੀ ਹੋਵੇ ਤਾਂ ਉਹ ਕਿਹੜੇ ਪੀਰਿਅਡ 'ਚ ਦਿੱਤੀ ਜਾਂਦੀ ਆ ਕੋਚਿੰਗ ਲੈਣ ਲਈ ਮਤਲਬ ਕੋਈ ਕਾਰਡ ਵਗੈਰਾ ਬਣਵਾਉਣਾ ਪੈਂਦਾ ਜਾਂ ਪ੍ਰਿੰਸੀਪਲ ਤੋਂ ਐਡਮੀਸ਼ਨ ਲੈਣੀ ਪੈਂਦੀ ਆ ਅਤੇ ਇਹਨਾਂ ਕੋਚਿੰਗ ਦੇ ਸਰ ਨੂੰ ਕੀ ਚਾਰਜਿਸ ਪੇਅ ਕਰਨੇ ਪੈਂਦੇ ਆ ਹਾਂਜੀ ਅਤੇ ਕੋਚਿੰਗ ਤੋਂ ਬਾਅਦ ਜਿਹੜੇ ਵਧੀਆ ਖਿਡਾਰੀ ਆ ਉਹਨਾਂ ਦੇ ਮੁਕਾਬਲੇ ਵਗੈਰਾ ਵੀ ਕਰਾਏ ਜਾਂਦੇ ਆ ਹਾਂਜੀ ਅਤੇ ਹੁਣ ਤੁਹਾਡੀ ਜਿਹੜਾ ਸਕੂਲ ਦਾ ਮਤਲਬ ਕਿ ਟੀਮ ਆ ਉਹ ਕਿਹੜੇ ਖੇ ਖੇਤਰ ਵਿੱਚ ਵਧੀਆ ਖੇਡਦੀ ਆ